ਹਾਂਜੀ ਮੈਂ ਪਿਛਲੇ ਦਿਨੀਂ ਇੱਕ ਚਿੱਤਰਕਾਰੀ ਬਣਾਈ ਸੀ ਜਿਸ ਦੇ ਵਿੱਚ ਮੈਂ ਪਿੰਡ ਦਾ ਚਿੱਤਰ ਬਣਾਇਆ ਸੀ ਜਿਵੇਂ ਪਿੰਡ ਦੇ ਵਿੱਚ ਔਰਤਾਂ ਖੂਹ ਤੋਂ ਪਾਣੀ ਭਰ ਰਹੀਆਂ ਹਨ ਕਈ ਪਾਣੀ ਭਰ ਕੇ ਲੈ ਕੇ ਜਾ ਰਹੀਆਂ ਹਨ ਇਹ ਚਿੱਤਰਕਾਰੀ ਬਣਾਉਣ ਸਮੇਂ ਯੂਟਿਊਬ ਗੂਗਲ ਵਟਸਅੱਪ ਵਗੈਰਾ ਤੋਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ ਮੈਂ ਹਾਲ ਹੀ ਵਿੱਚ ਇੱਕ ਜੋ ਚਿੱਤਰਕਾਰੀ ਬਣਾਈ ਹੈ ਪਿੰਡ ਦੀ ਉਹ ਬਹੁਤ ਵਧੀਆ ਚਿੱਤਰਕਾਰੀ ਬਣੀ ਹੈ ਇਹ ਸਭ ਮੈਂ ਯੂਟਿਊਬ ਤੋਂ ਵੇਖ ਕੇ ਬਣਾਈ ਸੀ ਅਤੇ ਇਹ ਚਿੱਤਰਕਾਰੀ ਮੇਰੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੈ ਅਤੇ ਸਭ ਨੂੰ ਬਹੁਤ ਪਸੰਦ ਆਈ ਹੈ ਅਤੇ ਸਭ ਨੇ ਬਹੁਤ ਹੀ ਇਸ ਦੀ ਪ੍ਰਸੰਸਾ ਕੀਤੀ ਹੈ ਅਤੇ ਮੈਨੂੰ ਖੁਦ ਨੂੰ ਵੀ ਬਹੁਤ ਵਧੀਆ ਅਨੁਭਵ ਹੋਇਆ ਹੈ